ਹਾਂਜੀ ਨਮਸਤੇ ਮੈਂ ਸੀਮਾ ਦੇਵੀ ਸੁਜਾਨਪੁਰ ਤੋਂ ਬੋਲਦੀ ਹਾਂ ਹਾਂਜੀ ਕਿ ਅੱਜ ਦੱਸਿਆ ਜਾਂਦਾ ਹੈ ਕਿ ਜਿੱਦਾਂ ਸਾਡੇ ਪੰਜਾਬ ਵਿੱਚ ਘੁੰਮਣ ਵਾਲੀਆਂ ਜਗ੍ਹਾ ਕਿਹੜੀਆਂ ਕਿਹੜੀਆਂ ਹਨ ਜਿੱਦਾਂ ਕਿ ਸੈਲਾਨੀ ਸੈਲਾਨੀ ਦੂਰੋਂ ਦੂਰੋਂ ਘੁੰਮਣ ਵਾਸਤੇ ਆਉਂਦੇ ਹਨ ਅਤੇ ਜਿੱਦਾਂ ਕਿ ਸਾਡੇ ਪਠਾਨਕੋਟ ਵਿੱਚ ਹੈ ਮਿੰਨੀ ਗੋਆ ਹੈ ਅਤੇ ਔਰ ਇੱਥੇ ਸੁਜਾਨਪੁਰ ਵਿੱਚ ਕੇ ਐਫ ਸੀ ਘੁੰਮਣ ਵਾਲੀ ਜਗ੍ਹਾ ਬਹੁਤ ਸੋਹਣੀ ਹੈ ਅਤੇ ਜਿੱਦਾਂ ਕਿ ਹਰਿਮੰਦਰ ਸਾਹਿਬ ਵਿੱਚ ਵੀ ਸੈਲਾਨੀ ਦੂਰੋਂ ਦੂਰੋਂ ਘੁੰਮਣ ਆਉਂਦੇ ਹਨ ਅਤੇ ਮੁਕੇਸਰਾਂ ਵਿੱਚ ਵੀ ਬਹੁਤ ਵਧੀਆ ਘੁੰਮਣ ਵਾਲੀ ਜਗ੍ਹਾ ਹੈ ਕਿ ਉੱਥੇ ਨਹਾਉਣ ਵਿੱਚ ਵੀ ਬਹੁਤ ਠੰਢਕ ਮਿਲਦੀ ਹੈ ਅਤੇ ਵਧੀਆ ਵਧੀਆ ਸਿਸਟਮ ਹੈ ਹਨ ਹਾਂਜੀ ਅਤੇ ਔਰ ਸਾਡੇ ਪੰਜਾਬ ਵਿੱਚ ਪਠਾਨਕੋਟ ਵਿੱਚ ਵੀ ਬਹੁਤ ਵਧੀਆ ਚੀਜ਼ਾਂ ਖੁੱਲ੍ਹ ਜਾਂਦੀਆਂ ਜਿੱਦਾਂ ਕਿ ਸੈਲਾਨੀ ਦੂਰੋਂ ਦੂਰੋਂ ਘੁੰਮ ਫਿਰ ਕੇ ਇਹਦਾ ਇੰਜੋਆਏ ਕਰ ਸਕਦੇ ਹਨ ਅਸੀਂ ਕੋਸਿਸ਼ ਸਾਡੀ ਹੈ ਕਿ ਅਸੀਂ ਬਹੁਤ ਵਧੀਆ ਕਰਕੇ ਪਠਾਨਕੋਟ ਵਿੱਚ ਵੀ ਇੰਜੋਆਏ ਕਰ ਸਕਦੇ ਹਨ ਜਿੱਦਾਂ ਕਿ ਸਾਡੇ ਨੇੜੇ ਤੇੜੇ ਪਾਰਕਾਂ ਵਿੱਚ ਵੀ ਬੱਚੇ ਵੱਡੇ ਬਜ਼ੁਰਗ ਜੋ ਵੀ ਹੈ ਕਿ ਬਹੁਤ ਵਧੀਆ ਤਰ੍ਹਾਂ ਘੁੰਮ ਫਿਰ ਕੇ ਇੰਜੋਆਏ ਕਰ ਸਕਦੇ ਹਨ ਦੀ ਕੋਸ਼ਿਸ਼ ਹੋਰ ਕਿ ਹਰ ਸਾਡੇ ਪੰਜਾਬ ਵਿੱਚ ਵੱਧ ਤੋਂ ਵੱਧ ਰੈਸਤੋਰੈਂਟ ਵੀ ਬਹੁਤ ਜ਼ਿਆਦਾ ਹਨ ਕਿ ਜਿੱਥੇ ਕਿ ਹਰ ਸੈਲਾਨੀ ਬਹੁਤ ਵਧੀਆ ਤਰੀਕੇ ਨਾਲ ਆਪਣਾ ਮਨੋਰੰਜਨ ਕਰ ਸਕਦੇ ਹਨ ਹਾਂਜੀ ਧੰਨਵਾਦ